ਪੰਜਾਬ ਵਿੱਚ ਵੱਖ ਵੱਖ ਧਰਮ ਪਾਏ ਜਾਂਦੇ ਹਨ ਜਿੱਦਾਂ ਕਿ ਸਿੱਖ ਮੁਸਲਮਾਨ ਹਿੰਦੂ ਈਸਾਈ ਅਤੇ ਇਹਨਾਂ ਧਰਮਾਂ ਦੇ ਅੰਦਰ ਹੋਰ ਵੀ ਬਹੁਤ ਜ਼ਿਆਦਾ ਵੰਡੀਆਂ ਕੀਤੀਆਂ ਹੁੰਦੀਆਂ ਹਨ ਅਸੀਂ ਆਮ ਤੌਰ 'ਤੇ ਦੇਖਦੇ ਹਾਂ ਕਿ ਅਸੀਂ ਪੰਜਾਬ ਦੇ ਵਿੱਚ ਸਾਰੇ ਧਰਮਾਂ ਨੂੰ ਇੱਕ ਬਰਾਬਰ ਸਮਾਨਤਾ ਦੇ ਨਾਲ ਮਨਾਉਂਦੇ ਹਾਂ ਜੇਕਰ ਅਸੀਂ ਦਿਵਾਲੀ ਦਾ ਤਿਉਹਾਰ ਦੇਖ ਲਈਆ ਲਿਆ ਜਾਵੇ ਤਾਂ ਫਿਰ ਹਿੰਦੂ ਅਤੇ ਮੁਸਲਮਾਨ ਦੋਨੋਂ ਅਤੇ ਸਿੱਖ ਸਾਰੇ ਇਹ ਤਿਉਹਾਰ ਨੂੰ ਬਹੁਤ ਹੀ ਧੂਮਧਾਮ ਦੇ ਨਾਲ ਮਨਾਉਂਦੇ ਹਨ ਜੇਕਰ ਅਸੀਂ ਸੱਭਿਆਚਾਰ ਦੇ ਅਦਾਨ ਪ੍ਰਦਾਨ ਦੀ ਗੱਲ ਕਰ ਹੀ ਰਹੇ ਹਾਂ ਤਾਂ ਅੱਜ ਕੱਲ੍ਹ ਅੰਤਰ ਧਰਮ ਵਿਆਹ ਵੀ ਹੋਣ ਲੱਗ ਗਏ ਹਨ ਜਿਸ ਨਾਲ ਲੋਕ ਇੱਕ ਤਰ੍ਹਾਂ ਨਾਲ ਇੱਕ ਦੂਜੇ ਦੇ ਨਾਲ ਭੇਦਭਾਵ ਖਤਮ ਕਰਦੇ ਜਾ ਰਹੇ ਹਨ ਅਤੇ ਲੋਕਾਂ ਨੂੰ ਅੱਜ ਕੱਲ੍ਹ ਬਹੁਤ ਸਾਰੇ ਸੈਮੀਨਾਰ ਲਗਾ ਕੇ ਇਨਸਾਨੀਅਤ ਦਾ ਪਾਠ ਪੜ੍ਹਾ ਕੇ ਇੱਕ ਰੱਬ ਨੂੰ ਮੰਨਣ ਦਾ ਇੱਕ ਬਹੁਤ ਹੀ ਚੰਗਾ ਪਾਠ ਜੋ ਹੈ ਪੜ੍ਹਾਇਆ ਜਾ ਰਿਹਾ ਹੈ ਜਿਸ ਨਾਲ ਸੰਵਾਦਾਂ ਦੇ ਜੋ ਹੱਲ ਨੇ ਉਹ ਬਹੁਤ ਹੀ ਜ਼ਿਆਦਾ ਹੋ ਰਹੇ ਹਨ ਅਤੇ ਮੁਸ਼ਕਲਾਂ ਜੋ ਨੇ ਧਰਮ ਦੇ ਨਾਂ ਦੇ ਉੱਤੇ ਲੜਾਈਆਂ ਖਤਮ ਹੁੰਦੀਆਂ ਜਾ ਰਹੀਆਂ ਹਨ ਇੱਕ ਰੱਬ ਨੂੰ ਮੰਨਣਾ ਅਤੇ ਇਨਸਾਨੀਅਤ ਦਾ ਜੋ ਪਾਠ ਹੈ ਉਸ ਦੇ ਨਾਲ ਲੋਕਾਂ ਦੇ ਵਿੱਚ ਆਪਸੀ ਸਮਝ ਅਤੇ ਬਣਤਰ ਬਹੁਤ ਵੱਧ ਗਈ ਹੈ ਅਤੇ ਲੋਕ ਇੱਕ ਦੂਸਰੇ ਦੇ ਧਰਮ ਨੂੰ ਅਪਣਾਉਣ ਲੱਗ ਗਏ ਹਨ ਇੱਕ ਦੂਜੇ ਦੇ ਧਰਮਾਂ ਨੂੰ ਮਾੜਾ ਬੋਲਣਾ ਖਤਮ ਕਰਕੇ ਅਤੇ ਹਰੇਕ ਦੇ ਧਰਮ ਦੀ ਜੋ ਅਹਿਮੀਅਤ ਹੈ ਉਹਨੂੰ ਸਮਝਣ ਦੇ ਨਾਲ ਅਸੀਂ ਆਪਣੇ ਧਰਮਾਂ ਦਾ ਸਤਿਕਾਰ ਕਰ ਰਹੇ ਹਾਂ